ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕਨਿਕਸ਼ਾ ਰਾਣੀ ਬੋਲ ਰਹੀ ਹਾਂ ਤੁਸੀਂ ਓਮ ਟਰੈਵਲਰ ਏਜੰਸੀ ਤੋਂ ਬੋਲ ਰਹੇ ਹੋ ਠੀਕ ਹੈ ਜੀ ਮੈਨੇ ਸੁਣਿਆ ਵੀ ਤੁਹਾਡੀ ਟਰੈਵਲਿੰਗ ਦੀ ਸਰਵਿਸ ਬਹੁਤ ਹੀ ਜ਼ਿਆਦਾ ਵਧੀਆ ਹੈਗੀ ਇਸ ਲਈ ਸਰ ਮੈਂ ਨਾ ਕੈਬ ਬੁੱਕ ਕਰਨਾ ਚਾਹੁੰਦੀ ਹਾਂ ਇੱਕ ਹਾਂਜੀ ਸਰ ਮੈਨੂੰ ਕੈਬ ਹਫ਼ਤਾ ਦਸ ਦਿਨਾਂ ਲਈ ਚਾਹੀਦੀ ਹੈ ਜੀ ਹਾਂਜੀ ਉਸ ਅਸੀਂ ਇੱਕ ਫੈਮਿਲੀ ਟਰਿੱਪ ਸੋਚੀ ਹੈ ਜੂਨ ਦੀ ਛੁੱਟੀਆਂ 'ਚ ਜਾਣ ਲਈ ਉਸ 'ਚ ਮੇਰੇ ਮੰਮਾ ਪਾਪਾ ਬਰਦਰ ਸਿਸਟਰ ਕਜ਼ਨਜ਼ ਸਭ ਹੋਣਗੇ ਹਾਂਜੀ ਅਸੀਂ ਜਾਣਾ ਹੈਗਾ ਜੀ ਨੋਰਥ ਵੱਲ ਜਿਵੇਂ ਹਿਮਾਚਲ ਪ੍ਰਦੇਸ਼ ਹੋ ਗਿਆ ਯੂ ਪੀ ਹੋ ਗਿਆ ਇੱਧਰਲੀ ਸਾਈਡ ਜਾਣਾ ਜੀ ਉੱਤਰਾਖੰਡ ਹੋ ਗਿਆ ਹਾਂਜੀ ਹਾਂਜੀ ਸਰ ਹਾਂਜੀ ਇਸ ਲਈ ਸਰ ਸਾਨੂੰ ਕੈਬ ਚਾਹੀਦੀ ਸੀਗੀ ਪੋਸੀਬਲ ਹੋ ਜੂਗੀ ਸਰ ਬੁੱਕ ਹੋ ਜੂਗੀ ਠੀਕ ਹੈ ਠੀਕ ਹੈ ਸਰ ਥੈਂਕ ਯੂ ਸਰ ਮੈਨੇ ਇੱਦਾਂ ਵੀ ਪੁੱਛਣਾ ਸੀਗਾ ਵੀ ਟੂਲ ਟੈਕਸ ਕਿਵੇਂ ਤੁਹਾਡਾ ਹੋਵੇਗਾ ਜਾਂ ਅਸੀਂ ਪੇ ਕਰਨਾ ਠੀਕ ਹੈ ਜੀ ਤੁਹਾਡਾ ਹੋਵੇਗਾ ਠੀਕ ਹੈ ਜੀ ਅਤੇ ਤੁਸੀਂ ਰੈਂਟ ਕਿੱਦਾਂ ਚਾਰਜ ਕਰੋਂਗੇ ਐਡਵਾਂਸ 'ਚ ਸਾਰੀ ਪੇਮੈਂਟ ਦੇਣੀ ਪਊਗੀ ਸਾਨੂੰ ਜਾਂ ਕੁਛ ਪੇਮੈਂਟ ਐਡਵਾਂਸ 'ਚ ਕੁਛ ਇਸ ਤੋਂ ਬਾਅਦ ਠੀਕ ਹੈ ਜੀ ਹਾਫ ਐਡਵਾਂਸ ਹੋਊਂਗੇ ਹਾਫ ਬਾਅਦ 'ਚੋਂ ਠੀਕ ਹੈ ਜੀ ਅਤੇ ਸਰ ਤੁਸੀਂ ਰੈਂਟ ਕਿਸ ਤਰੀਕੇ ਨਾਲ ਚਾਰਜ ਕਰੋਂਗੇ ਜਿੰਨੇ ਦਿਨ ਆਪਾਂ ਗੱਡੀ ਲੈ ਕੇ ਜਾ ਰਹੇ ਹਾਂ ਉਹਦੇ ਹਿਸਾਬ ਨਾਲ ਜਾਂ ਫਿਰ ਕਿਲੋਮੀਟਰ ਦੇ ਹਿਸਾਬ ਨਾਲ ਠੀਕ ਹੈ ਸਰ ਠੀਕ ਹੈ ਕਿਲੋਮੀਟਰ ਦੇ ਹਿਸਾਬ ਨਾਲ ਠੀਕ ਹੈ ਸਰ ਕੋਈ ਪ੍ਰੋਬਲਮ ਨਹੀਂ ਸਰ ਠੀਕ ਹੈ ਹਾਂਜੀ ਸਰ ਹਾਂਜੀ ਬਸ ਸਰ ਇੱਕ ਰਿਕੁਐਸਟ ਹੈਗੀ ਪਲੀਜ਼ ਜਿਹੜੀ ਤੁਸੀਂ ਗੱਡੀ ਭੇਜੋਂਗੇ ਉਹ ਬਸ ਪ੍ਰੋਪਰ ਸਰਵਿਸ ਕੀਤੀ ਹੋਣੀ ਚਾਹੀਦੀ ਹੈ ਉਸ ਗੱਡੀ ਦੀ ਤਾਂ ਜੋ ਸਰ ਵਿੱਚ ਦੀ ਵਾਪਿਸ ਖਰਾਬ ਨਾ ਹੋ ਜਾਵੇ ਕਿਤੇ ਟਰਿੱਪ ਹੀ ਖਰਾਬ ਹੋ ਜਾਵੇ ਆਪਣੀ ਹੈ ਨਾ ਠੀਕ ਹੈ ਸਰ ਠੀਕ ਹੈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਸਰ ਠੀਕ ਹੈ ਅਤੇ ਸਰ ਇੱਦਾਂ ਦੱਸਿਓ ਵੀ ਗੱਡੀ ਆਪਾਂ ਰਸਤੇ 'ਚ ਰੋਕ ਪਾਵਾਂਗੇ ਨਾ ਮਤਲਬ ਵੀ ਡਰਾਈਵਰ ਇੱਦਾਂ ਤਾਂ ਨਹੀਂ ਕਹਿੰਦਾ ਵੀ ਗੱਡੀ ਮੈਂ ਰੋਕਦਾ ਨਹੀਂ ਐਵੇਂ ਕੁਛ ਠੀਕ ਹੈ ਸਰ ਠੀਕ ਹੈ ਅੱਛਾ ਠੀਕ ਹੈ ਜੀ ਗੱਡੀ ਆਰਾਮ ਨਾਲ ਰੋਕ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਫਿਰ ਸਰ ਇੱਕ ਕਨਿਸ਼ਕਾ ਰਾਣੀ ਦੇ ਨਾਂ 'ਤੇ ਇੱਕ ਕੈਬ ਬੁੱਕ ਕਰ ਦਿਓ ਸੋ ਸਾਨੂੰ ਚਾਹੀਦੀ ਹੈਗੀ ਪਲੀਜ਼ ਹਾਂਜੀ ਸਰ ਹਾਂਜੀ ਆਹ ਬਸ ਤੁਸੀਂ ਐਂ ਕਰਿਓ ਕੱਲ੍ਹ ਸ਼ਾਮ ਨੂੰ ਚਾਰ ਵਜੇ ਤੱਕ ਭੇਜ ਦਿਓ ਗੱਡੀ ਘਰ ਹਾਂਜੀ ਸਰ ਹਾਂਜੀ ਠੀਕ ਹੈ ਜੀ ਠੀਕ ਹੈ ਤੁਹਾਨੂੰ ਐਡਰੈਸ ਲਿਖਵਾ ਦਿੰਦੇ ਹਾਂ ਜੀ ਵਾਰਡ ਨੰਬਰ ਗਿਆਰ੍ਹਾਂ ਆਪਣਾ ਭਿੱਖੀ ਹੈ ਹਾਂਜੀ ਸਰ ਹਾਂਜੀ ਠੀਕ ਹੈ ਸਰ ਥੈਂਕ ਯੂ